ਪੰਜਾਬ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ 'ਚ ਆਏ ਦਿਨ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ ਅਸੀ ਦੇਖਦੇ ਕਿ ਪੰਜਾਬ ਦੇ ਹਰ ਮਹੀਨੇ ਵਿੱਚ ਕੋਈ ਨਾ ਕੋਈ ਤਿਉਹਾਰ ਬੜੇ ਹੀ ਧੂਮਧਾਮ ਨਾਲ਼ ਮਨਾਇਆ ਜਾਂਦਾ ਹੈ ਸ਼ੁਰੂਆਤ ਅਗਰ ਜਨਵਰੀ ਮਹੀਨੇ ਤੋਂ ਤਾਂ ਜਨਵਰੀ ਮਹੀਨੇ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ਼ ਮਨਾਇਆ ਜਾਂਦਾ ਹੈ ਫਰਵਰੀ ਮਹੀਨੇ ਵਿੱਚ ਅਸੀਂ ਗੱਲ ਕਰੀਏ ਤਾਂ ਬਸੰਤ ਦਾ ਦਾ ਤਿਉਹਾਰ ਮਾਰਚ 'ਚ ਹੋਲੀ ਦਾ ਤਿਉਹਾਰ ਅਪ੍ਰੈਲ ਵਿੱਚ ਵਿਸਾਖੀ ਦਾ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ਼ ਮਨਾਇਆ ਜਾਂਦਾ ਹੈ ਇਹ ਨਹੀਂ ਕਿ ਸਿਰਫ਼ ਇੱਥੇ ਇੱਕ ਧਰਮ ਇੱਕ ਹੀ ਧਰਮ ਦੇ ਤਿਉਹਾਰ ਮਨਾਏ ਜਾਂਦੇ ਹਨ ਹ ਹਿੰਦੂ ਚਾਹੇ ਮੁਸਲਿਮ ਹੈ ਚਾਹੇ ਸਿੱਖ ਹੈ ਚਾਹੇ ਉਹ ਇਸਾਈ ਹੈ ਹਰੇਕ ਧਰਮ ਦਾ ਆਪਣਾ ਆਪਣਾ ਤਿਉਹਾਰ ਬੜੇ ਉਤਸ਼ਾਹ ਦੇ ਨਾਲ਼ ਬੜੇ ਹੀ ਜੋਸ਼ ਦੇ ਨਾਲ਼ ਮਨਾਇਆ ਜਾਂਦਾ ਹੈ ਇਹਦੇ ਵਿੱਚ ਦਿਵਾਲੀ ਕ੍ਰਿਸਮਿਸ ਹੋ ਗਿਆ ਵਿਸਾਖੀ ਹੋ ਗਿਆ ਰਕਸ਼ਾ ਬੰਧਨ ਮਨ ਨਵਰਾਤਰੇ ਹੋ ਗਏ ਹਰ ਕੋਈ ਤਿਉਹਾਰ ਚਾਹੇ ਉਹ ਕਿਸੇ ਵੀ ਧਰਮ ਦਾ ਹੈ ਉਹ ਹਰੇਕ ਤਿਉਹਾਰ ਨੂੰ ਬੜੀ ਧੂਮਧਾਮ ਨਾਲ਼ ਮਨਾਇਆ ਜਾਂਦਾ ਹੈ